ਵੈਸੇ ਤਾਂ ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਕਿਉਂਕਿ ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਜਿੱਥੇ ਬਹੁਤ ਸਾਰੇ ਲੋਕ ਅਲੱਗ ਅਲੱਗ ਧਰਮਾਂ ਅਤੇ ਜਾਤਾਂ ਤੋਂ ਰਹਿੰਦੇ ਹਨ ਅਤੇ ਆਪਣੇ ਧਰਮਾਂ ਅਤੇ ਜਾਤਾਂ ਦੇ ਅਕੌਰਡਿੰਗ ਉਹ ਤਿਉਹਾਰ ਮਨਾਉਂਦੇ ਹਨ ਪਰ ਪੂਰੇ ਭਾਰਤ ਵਿੱਚ ਇੱਕ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਹਦਾ ਨਾਮ ਦਿਵਾਲੀ ਹੈ ਸੋ ਦਿਵਾਲੀ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਨੇਕੀ ਦੀ ਬਦੀ ਉੱਤੇ ਜਿੱਤ ਹੈ ਜੋ ਕਿ ਹਿੰਦੂ ਧਰਮ ਦਾ ਇੱਕ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਹਰਾ ਕੇ ਉਸ ਤੋਂ ਬਾਅਦ ਕੀ ਹੈ ਆਪਣੇ ਘਰ ਅਯੋਧਿਆ ਉਹ ਵਾਪਸ ਆਏ ਸੀ ਜਿਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਕੀ ਹੈ ਦੀਪ ਜਲਾਏ ਸਨ ਸੋ ਉਹਨਾਂ ਦਾ ਚੌਦਾਂ ਸਾਲ ਦਾ ਬਨਵਾਸ ਸੀਗਾ ਜਿਸ ਤੋਂ ਬਾਅਦ ਅਯੋਧਿਆ ਵਾਪਸ ਆਏ ਸੀ ਸੋ ਜਿਸ ਦੇ ਕਾਰਨ ਇਹ ਤਿਉਹਾਰ ਉੱਦੋਂ ਤੋਂ ਹੀ ਮਨਾਇਆ ਜਾਂਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਦਿਨ ਛੁੱਟੀ ਵੀ ਕੀਤੀ ਜਾਂਦੀ ਹੈ ਸੋ ਇਸ ਤਿਉਹਾਰ ਨੂੰ ਮਨਾਉਣ ਦੇ ਅੱਜ ਕੱਲ੍ਹ ਜੋ ਤਰੀਕੇ ਹਨ ਉਹਨਾਂ ਵਿੱਚ ਬਹੁਤ ਫਰਕ ਵੀ ਆ ਗਿਆ ਹੈ ਸੋ ਅੱਜ ਕੱਲ੍ਹ ਇਸ ਤਿਉਹਾਰ 'ਤੇ ਦੀਵਿਆਂ ਦੇ ਨਾਲ ਨਾਲ ਕੀ ਹੈ ਬੱਚਿਆਂ ਨੂੰ ਪਟਾਕੇ ਵੀ ਚਲਾਏ ਜਾਂਦੇ ਹਨ ਅਤੇ ਲੋਕ ਮਠਿਆਈ ਵੀ ਇੱਕ ਦੂਸਰੇ ਨੂੰ ਗਿਫਟ ਦੇ ਤੌਰ 'ਤੇ ਦਿੰਦੇ ਹਨ ਅਤੇ ਆਪਣੀਆਂ ਖੁਸ਼ੀਆਂ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰਦੇ ਹਨ ਸੋ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਹੈ ਸੋ ਜਿਸਦਾ ਕੀ ਹੈ ਅੱਜ ਕੱਲ੍ਹ ਅਗਰ ਅਸੀਂ ਦੇਖੀਏ ਤਾਂ ਇਹ ਪੂਰੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਜਿੱਥੇ ਜਿੱਥੇ ਵੀ ਭਾਰਤੀ ਲੋਕ ਰਹਿੰਦੇ ਹਨ ਉਹ ਉੱਥੇ ਹੀ ਆਪਣੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਆਪਣੇ ਜੋ ਪੂਰਵਜ ਹਨ ਜੋ ਉਹਨਾਂ ਦੇ ਦੇਵੀ ਦੇਵਤੇ ਹਨ ਉਹਨਾਂ ਨੂੰ ਪੂਜਦੇ ਹਨ ਅਤੇ ਉਹਨਾਂ ਦੀ ਸੇਵਾ ਵੀ ਕਰਦੇ ਹਨ ਆਪਣੇ ਬਜ਼ੁਰਗਾਂ ਦੀ ਸੋ ਭਾਰਤ ਦੇ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰ ਦਿਵਾਲੀ ਹੈ ਜਿਹਦੇ ਨਾਲ ਹੀ ਕੀ ਹੈ ਵਿਸ਼ਕਰਮਾ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਅਤੇ ਭਾਈਦੂਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਸੋ ਇਹ ਤਿੰਨੋ ਹੀ ਤਿਉਹਾਰ ਇਕੱਠੇ ਮਨਾਏ ਜਾਂਦੇ ਹਨ